ਫੋਟੋਗ੍ਰਾਫੀ ਨੂੰ ਪੇਸ਼ੇ ਵਜੋਂ ਬਣਾਉਣ ਲਈ ਮੈਂ ਤੁਹਾਨੂੰ ਇਹ ਹੀ ਸਲਾਹ ਦੇਵਾਂਗੀ ਕਿ ਫੋਟੋਗ੍ਰਾਫੀ ਨੂੰ ਪਹਿ ਸਭ ਤੋਂ ਪਹਿਲਾਂ ਕੋਲਜ ਤੋਂ ਡਿਗਰੀ ਲੈਣੀ ਚਾਹੀਦੀ ਹੈ ਅਤੇ ਬਹੁਤ ਸਾਰੇ ਫੋਟੋਗ੍ਰਾਫਰਸ ਤੋਂ ਉਹਨਾਂ ਦੇ ਟਿਪਸ ਅਤੇ ਟ੍ਰਿਕਸ ਲੈਣੇ ਚਾਹੀਦੇ ਆ ਅਤੇ ਉਹਨਾਂ ਦੇ ਸੈਮੀਨਾਰਸ ਵੀ ਸਾਨੂੰ ਅਟੈਂਡ ਕਰਨੇ ਚਾਹੀਦੇ ਹਨ ਤਾਂ ਜੋ ਵਧੀਆ ਫੋਟੋਗ੍ਰਾਫਰ ਬਣ ਸਕਣ ਅਤੇ ਫੋਟੋਗ੍ਰਾਫੀ ਅੱਛੀ ਕਰ ਸਕਣ ਅਤੇ ਵਾਤਾਵਰਣ ਅਤੇ ਬੈਕਗਰਾਊਂਡ ਵੀ ਵਧੀਆ ਤਰੀਕੇ ਨਾਲ਼ ਸਮਝਣ ਦੀ ਕੋਸ਼ਿਸ਼ ਕਰ ਸਕਣ